ਮੇਰਾ ਪਹਿਲਾ ਪ੍ਰੋਡਕਟ ਔਨਲਾਈਨ ਸ਼ੋਪਿੰਗ ਵਿੱਚ ਮੈਂ ਦੱਸਣਾ ਚਾਹਾਂਗਾ ਕਿ ਮੈਂ ਇੱਕ ਕਮੀਜ਼ ਖਰੀਦੀ ਕੋਟਨ ਮੇਅਰ ਸ਼ਰਟ ਜੋ ਕਿ ਬਹੁਤ ਹੀ ਵਧੀਆ ਰਹੀ ਉਹਦਾ ਕੱਪੜਾ ਵੀ ਬਹੁਤ ਵਧੀਆ ਸੀ ਗਰਮੀ 'ਚ ਵੀ ਪਾਉਣ 'ਚ ਬਹੁਤ ਵਧੀਆ ਰਹੀ ਕੋਈ ਗਰਮੀ ਉਹ 'ਚ ਪਾ ਕੇ ਨਹੀਂ ਲੱਗੀ ਕਿਉਂਕਿ ਕੋਟਨ ਮੇਅਰ ਸੀਗੀ ਬਹੁਤ ਹੀ ਵਧੀਆ ਸੀਗੀ ਅਤੇ ਰੰਗ ਵੀ ਉਹਦਾ ਬਹੁਤ ਸੋਹਣਾ ਸੀ ਵਾਰ ਵਾਰ ਧੋਣ ਨਾਲ ਵੀ ਉਹਦਾ ਰੰਗ ਉਤਰਿਆ ਨਹੀਂ ਬਹੁਤ ਵਧੀਆ ਲੱਗੀ ਅਤੇ ਜਦੋਂ ਮੈਂ ਪਾਈ ਸੀਗੀ ਸਾਰਿਆਂ ਨੇ ਹੀ ਉਸ ਕਮੀਜ਼ ਨੂੰ ਸਰਹਾਇਆ ਅਤੇ ਵਾਰ ਵਾਰ ਪੁੱਛਿਆ ਕਿ ਕਿੱਥੋਂ ਲਈ ਹੈ ਕਿੱਥੋਂ ਲਈ ਹੈ ਅਤੇ ਮੈਂ ਵੀ ਦੱਸਿਆ ਕਿ ਔਨਲਾਈਨ ਸ਼ੋਪਿੰਗ ਕੀਤੀ ਹੈ ਉਸ ਦੀ ਕੀਮਤ ਵੀ ਪੁੱਛੀ ਅਤੇ ਕੀਮਤ ਵੀ ਉਹ ਸੁਣ ਕੇ ਹੈਰਾਨ ਹੋ ਗਏ ਕਿ ਇੰਨੀ ਘੱਟ ਕੀਮਤ 'ਤੇ ਤਾਂ ਅੱਜ ਕੱਲ੍ਹ ਕੱਪੜਾ ਵੀ ਨਹੀਂ ਆਉਂਦਾ ਸਵਾਈ ਉੱਤੋਂ ਵੱਖਰੀ ਦੇਣੀ ਪੈਂਦੀ ਹੈ ਅਤੇ ਇੱਡੀ ਸੋਹਣੀ ਸ਼ਰਟ ਕਿਵੇਂ ਤੁਸੀਂ ਕਿ ਕਿੱਥੋਂ ਲਈ ਫਿਰ ਮੈਂ ਉਹਨੂੰ ਸਾਰੀ ਸਾਰਿਆਂ ਨੂੰ ਹੀ ਦੱਸਿਆ ਕਿ ਇੱਦਾਂ ਇੱਦਾਂ ਮੈਂ ਕਰਕੇ ਔਨਲਾਈਨ ਸ਼ੋਪਿੰਗ ਕਰਕੇ ਇੰਨੀ ਸਸਤੀ ਘੱਟ ਕੀਮਤ 'ਤੇ ਐਡੀ ਵਧੀਆ ਸ਼ਰਟ ਲਈ ਹੈ ਅਤੇ ਉਹਨਾਂ ਨੇ ਵੀ ਕਿਹਾ ਕਿ ਸਾਨੂੰ ਵੀ ਐਵੇਂ ਦੇ ਓ ਸ਼ਰਟ ਔਡਰ ਕਰਕੇ ਦਿਉ ਅਤੇ ਬਹੁਤ ਇੰਨੀ ਵਧੀਆ ਸ਼ਰਟ ਮੈਂ ਤੁਹਾਨੂੰ ਵੀ ਕੰਮ ਕਹਿਣਾ ਚਾਹਾਂਗਾ ਕਿ ਅਗਰ ਜੇ ਤੁਹਾਨੂੰ ਚਾਹੀਦੀ ਹੈ ਤਾਂ ਮੇਰੇ ਕੋਲ ਉਸ ਔਨਲਾਈਨ ਸ਼ੋਪਿੰਗ ਦਾ ਲਿੰਕ ਲੈ ਲਿਓ ਤੁਸੀਂ ਵੀ ਵੇਖੋਗੇ ਉਸ ਔਨਲਾਈਨ ਸ਼ੋਪਿੰਗ ਵਿੱਚ ਇੰਨੀਆਂ ਵਧੀਆ ਤੋਂ ਵਧੀਆ ਵੱਧ ਕੇ ਵੱਧ ਚੀਜ਼ਾਂ ਤਾਂ ਘੱਟ ਕੀਮਤ 'ਤੇ ਹਨ ਜਿਸ ਦਾ ਪ੍ਰਯੋਗ ਅਸੀਂ ਕਰਕੇ ਬਹੁਤ ਵਧੀਆ ਰਹਾਂਗੇ